ਅਸੀਂ ਆਪਣੇ ਬਣਾਏ ਗਏ ਪਕਵਾਨਾਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਸਿਖਾਉਂਦੇ ਹਨ ਜਿਵੇਂ ਕਿ ਉਹਨਾਂ ਨੂੰ ਅਸੀਂ ਜੇ ਕੋਈ ਅਸੀਂ ਕੋਈ ਪਕਵਾਨ ਬਣਾਇਆ ਅਤੇ ਅਸੀਂ ਉਸ ਦੇ ਨਾਲ ਨਾਲ ਵੀਡੀਓ ਬਣਾ ਲੈਂਦੇ ਹਨ ਅਤੇ ਫੇਸਬੁੱਕ 'ਤੇ ਪਾ ਦਿੰਦੇ ਹਨ ਜਿਸ ਕਾਰਨ ਕਈ ਲੋਕ ਸਾਡੇ ਬਣਾਏ ਗਏ ਪਕਵਾਨਾਂ ਨੂੰ ਸਿੱਖ ਲੈਂਦੇ ਹਨ ਅਤੇ ਸਾਨੂੰ ਉਹਨਾਂ ਪਕਵਾਨਾਂ ਨੂੰ ਬਣਾਉਣ ਦਾ ਮੌਕਾ ਵੀ ਵਾਰ ਵਾਰ ਮਿਲਦਾ ਹੈ ਅਤੇ ਜੇ ਕੋਈ ਆਪਣੇ ਆਸ ਪਾਸ ਦਾ ਕੋਈ ਔਰਤ ਹੋਵੇ ਜੋ ਕਿ ਸਾਡੇ ਭੋਜਨ ਨੂੰ ਬਹੁਤ ਪਸੰਦ ਕਰਦੀ ਹੋਵੇ ਤਾਂ ਉਹ ਸਾਡੇ ਕੋਲ ਆ ਕੇ ਸਾਡੇ ਲਾਗੇ ਖੜੀ ਹੋ ਕੇ ਸਾਡੇ ਦੁਆਰਾ ਬਣਾਏ ਗਏ ਸਬਜ਼ੀ ਜਿਵੇਂ ਕਿ ਉਹਦੇ ਵਿੱਚ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਮਸਾਲੇ ਕੀ ਕੀ ਪਾਉਂਦੇ ਹਨ ਉਹ ਸਭ ਦੇਖ ਕੇ ਹੀ ਸਿੱਖ ਜਾਂਦੇ ਹਨ